ਤੇਈ ਨਵੰਬਰ ਦੋ ਹਜ਼ਾਰ ਪੰਜ ਚਾਰ ਦਸੰਬਰ ਦੋ ਹਜ਼ਾਰ ਛੇ ਪੱਚੀ ਨਵੰਬਰ ਦੋ ਹਜ਼ਾਰ ਤਿੰਨ ਇੱਕੀ ਦਸੰਬਰ ਦੋ ਹਜ਼ਾਰ ਇੱਕ ਤੇਈ ਐਪਰਲ ਦੋ ਹਜ਼ਾਰ ਸੱਤ